ਜਿਸ ਤਰ੍ਹਾਂ ਕਿ ਦੇਸ਼ ਵਿੱਚ ਬਹੁਤ ਸਾਰੇ ਸਰਕਾਰੀ ਹੋਸਪਿਟਲ ਪ੍ਰਾਈਵੇਟ ਉਪਲਬਧ ਨੇ ਮੈਂ ਜਿਸ ਤਰ੍ਹਾਂ ਆਪਣੇ ਹੋਸਪਿਟਲ ਨਵਾਂ ਸ਼ਹਿਰ ਅਤੇ ਸਰਕਾਰੀ ਹੋਸਪਿਟਲ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਉੱਥੇ ਬਹੁਤ ਸਾਰੇ ਕਈ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਕੁਛ ਕੁ ਨੇ ਕਿ ਜਿਸ ਤਰ੍ਹਾਂ ਕੋਈ ਕੇਅਰ ਕੇਅਰ ਤਾਂ ਬਹੁਤ ਹੁੰਦੀ ਹੈ ਪਰ ਡਾਕਟਰ ਜਿੱਦਾਂ ਟਵੇਂ ਸਮੇਂ ਸਿਰ ਨਹੀਂ ਬੈਠਦੇ ਉਹਨਾਂ ਨੂੰ ਮਿਲਣ ਵਾਸਤੇ ਜਿੱਦਾਂ ਸਿਫਾਰਿਸ਼ ਸਿਫਾਰਿਸ਼ ਜ਼ਿਆਦਾ ਚੱਲਦੀ ਹੈ ਬਾਹਰ ਵੀ ਉਹਨਾਂ ਨੇ ਆਪਣੇ ਪ੍ਰਾਈਵੇਟ ਹੋਸਪਿਟਲ ਖੋਲ੍ਹੇ ਨੇ ਜੇ ਉੱਥੇ ਜਾਓ ਤਾਂ ਉਹ ਵਧੀਆ ਵਧੀਆ ਮਿਲਦੇ ਨੇ ਗੱਲਾਂ ਕਰਦੇ ਨੇ ਜੇ ਆਪਾਂ ਸਰਕਾਰੀ ਜਾਈਏ ਤਾਂ ਉਹ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀ ਸੁਣਵਾਈ ਨਹੀਂ ਹੁੰਦੀ ਔਰ ਇੱਥੇ ਕਾਫੀ ਮਤਲਬ ਜਿੱਦਾਂ ਕਿ ਕਈ ਚੀਜ਼ਾਂ ਨੇ ਜਿਹਨਾਂ ਵਿੱਚ ਕੁਛ ਕਮੀਆਂ ਨੇ ਪਰ ਕੁਛ ਚੀਜਾਂ ਵਧੀਆ ਵੀ ਨੇ ਜਿਸ ਦਾ ਕੋਵਿਡ ਟਾਈਮ ਦੀ ਗੱਲ ਕਰੀਏ ਤਾਂ ਉਸ ਟਾਈਮ ਕਾਫੀ ਕਾਫੀ ਹੋਸਪਿਟਲਾਂ ਵਿੱਚ ਜਿੱਦਾਂ ਚੱਜ ਨਾਲ ਵਧੀਆ ਦੇਖਭਾਲ ਨਹੀਂ ਕੀਤੀ ਗਈ ਪਰ ਨਵਾਂ ਸ਼ਹਿਰ ਦੇ ਸਾਡੇ ਸਰਕਾਰੀ ਹੋਸਪਿਟਲ ਵਿੱਚ ਬਹੁਤ ਵਧੀਆ ਟਰੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਤੇ ਲੋਕਾਂ ਨੂੰ ਸਿਹਤ ਸੰਬੰਧੀ ਸਹੂਲਤਾਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿੱਦਾਂ ਕਿ ਪ੍ਰਾਈਵੇਟ ਹੋਸਪਿਟਲ ਨੇ ਪ੍ਰਾਈਵੇਟ ਹੋਸਪਿਟਲਾਂ ਵਿੱਚ ਇਲਾਜ ਤਾਂ ਵਧੀਆ ਤੋਂ ਵਧੀਆ ਹੁੰਦਾ ਪਰ ਜਿਹੜੇ ਦਿਹਾੜੀਦਾਰ ਮਜ਼ਦੂਰ ਬੰਦੇ ਨੇ ਉਹ ਇਲਾਜ ਨਹੀਂ ਕਰਾ ਸਕਦੇ ਇਸ ਲਈ ਸਾਨੂੰ ਸਰਕਾਰੀ ਹੋਸਪਿਟਲ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਕਿ ਵਧੀਆ ਤੋਂ ਵਧੀਆ ਦੇਖਭਾਲ ਕੀਤੀ ਜੀ ਕਰ ਸਕਣ ਅਤੇ ਲੋਕਾਂ ਨੂੰ ਇਹਨਾਂ ਦਾ ਫਾਇਦਾ ਮਿਲ ਸਕੇ ਕਿ ਜਿਹੜੇ ਮਜ਼ਦੂਰ ਬੰਦੇ ਨੇ ਉਹ ਆਪਣਾ ਇਲਾਜ ਨਹੀਂ ਕਰਾ ਸਕਦੇ ਅਤੇ ਉਹਨਾਂ ਨੂੰ ਸਰਕਾਰੀ ਹੀ ਜਾਣਾ ਪੈਂਦਾ ਏ ਹੋਸਪਿਟਲਾਂ ਦੇ ਪ੍ਰਾਈਵੇਟ ਹੋਸਪਿਟਲਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਜੋ ਕਿ ਆਪ ਹਰੇਕ ਕਿਸੇ ਦੇ ਵੱਸ ਵਿੱਚ ਨਹੀਂ ਹੈ ਉਹ ਇਲਾਜ ਕਰਾਉਣਾ ਇਸ ਲਈ ਸਾਨੂੰ ਸਾਡਾ ਹੋਸਪਿਟਲ ਸਰਕਾਰੀ ਬਹੁਤ ਵਧੀਆ ਹੈ ਕਿ ਬਹੁਤ ਸੋਹਣੀ ਕੇਅਰ ਕਰਦੇ ਹੈ ਅਤੇ ਮੈਂ ਤਾਂ ਇਹਦੇ ਵਿੱਚ ਇਹੀ ਹੈ ਕਿ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਏ ਤਾਂ ਕਿ ਜਿਹੜਾ ਕੋਈ ਦਿਹਾੜੀਦਾਰ ਮਜ਼ਦੂਰ ਬੰਦਾ ਏ ਗਰੀਬ ਹੈ ਉਹ ਆਪਣਾ ਇਲਾਜ ਕਰਾ ਕੇ ਸੁਖੀ ਰਹਿ ਸਕੇ